ਜਦੋਂ ਮੈਂ ਆਪਣੀ ਕੋਈ ਵੀ ਚਿੱਤਰ ਵਗੈਰਾ ਬਣਾਉਂਦੀ ਹੈਗੀ ਪੇਟਿੰਗ ਕੋਈ ਵੀ ਰੈਡੀ ਕਰਦੀ ਹੈਗੀ ਹਾਂ ਚਾਹੇ ਉਹ ਕਿਸੇ ਦੀ ਫੋਟੋ ਵਗੈਰਾ ਮੈਂ ਤਿਆਰ ਕੀਤੀ ਹੈਗੀ ਹਾਂ ਕਿਸੇ ਦੀ ਫੈਮਲੀ ਫੋਟੋ ਤਿਆਰ ਕੀਤੀ ਹੈਗੀ ਆ ਅਤੇ ਉਹ ਜਿਹੜੀ ਮੈਂ ਫੈਮਲੀ ਫੋਟੋ ਤਿਆਰ ਕੀਤੀ ਹੈ ਜਾਂ ਕਿਸੇ ਦੀ ਪਰਸਨਲ ਸਿਰਫ ਇੱਕ ਜਣੇ ਦੀ ਮੈਂ ਆਪਣੀ ਫੋਟੋ ਤਿਆਰ ਕੀਤੀ ਹੈਗੀ ਆਪਣੀ ਕਿਸੇ ਫਰੈਂਡ ਦੀ ਤਿਆਰ ਕੀਤੀ ਆ ਅਤੇ ਉਸ ਚੀਜ਼ ਨੂੰ ਮੈਂ ਫਰੇਮ ਕਰਵਾ ਲੈਂਦੀ ਹੈਗੀ ਹਾਂ ਕਿਉਂਕਿ ਫਰੇਮਿੰਗ ਕਰਨ ਨਾਲ ਤਾਂ ਇੱਕ ਤਾਂ ਜਿਹੜੀ ਡਰਾਇੰਗ ਦੀ ਲੁੱਕ ਹੈਗੀ ਹੈ ਇੱਕ ਉਹ ਵੀ ਚੇਂਜ ਹੋ ਜਾਂਦੀ ਆ ਮ ਸੋਹਣੀ ਲੱਗਦੀ ਆ ਵੇਖਣ ਨੂੰ ਫਰੇਮ ਨਾਲ ਲੁੱਕ ਚੇਂਜ ਹੋ ਜਾਂਦੀ ਆ ਫਿਰ ਉਹਨੂੰ ਮੈਂ ਕੀ ਹੈ ਘਰ ਦੀ ਕੰਧ ਵਗੈਰਾ 'ਤੇ ਟੰਗ ਦਿੰਦੀ ਹੈਗੀ ਹਾਂ ਜਾਂ ਕਿਸੇ ਦੀ ਹੋਵੇ ਤਾਂ ਉਹਨੂੰ ਮੈਂ ਦੇ ਦਿੰਦੀ ਹੈਗੀ ਰੈਡੀ ਕਰਕੇ ਅਤੇ ਫਰੇਮ ਕਰਨ ਨਾਲ ਕੀ ਜਿਹੜੇ ਸਾਈਡ ਦੇ ਜਿਹੜੇ ਕੌਰਨਰਸ ਹੁੰਦੇ ਆ ਪੇਂਟਿੰਗ ਦੇ ਉਹ ਵੀ ਖਰਾਬ ਨਹੀਂ ਹੁੰਦੇ ਅਤੇ ਪੇਂਟਿੰਗ ਦੀ ਜਿਹੜੀ ਲੁੱਕ ਹੁੰਦੀ ਆ ਇੱਕ ਉਹ ਵੀ ਸੋਹਣੀ ਲੱਗਦੀ ਹੈਗੀ ਆ ਅਤੇ ਇਸ ਕਰਕੇ ਮੈਂ ਆਪਣੇ ਜਿਹੜੇ ਪੇਂਟਿੰਗਜ਼ ਨੂੰ ਜ਼ਿਆਦਾਤਰ ਕੀ ਆ ਫਰੇਮਿੰਗ ਹੀ ਕਰਵਾਉਂਦੀ ਹੁੰਦੀ ਹਾਂ ਫਰੇਮਿੰਗ ਕਰਨ ਦੇ ਨਾਲ ਅਲੱਗ ਅਲੱਗ ਫਰੇਮ ਜਦੋਂ ਆ ਜਾਂਦੇ ਆ ਸੋਹਣੇ ਸੋਹਣੇ ਫਰੇਮ ਲੱਗ ਜਾਂਦੇ ਹੈਗੇ ਪੇਟਿੰਗ ਦੇ ਸਾਈਡ ਸਾਈਡ 'ਤੇ ਫਰੇਮਿੰਗ ਨਾਲ ਉਹਦੀ ਜਿਹੜੀ ਲੁੱਕ ਆ ਚੇਂਜ ਹੋ ਜਾਂਦੀ ਆ ਫਰੇਮਿੰਗ ਚਾਹੇ ਮੈਂ ਵੁਡਨ ਦੀ ਕਰਵਾ ਲਵਾਂ ਕਿਸੇ ਗਲਾਸ ਵਗੈਰਾ ਦੀ ਸਾਈਡ 'ਤੇ ਕਰਵਾ ਲਵਾਂ ਜਿੰਨਾ ਮਹਿੰਗਾ ਫਰੇਮ ਹੋਊਗਾ ਜਿੰਨਾ ਵਧੀਆ ਫਰੇਮ ਹੋਊਗਾ ਉਹ ਓਨਾ ਹੀ ਸੋਹਣਾ ਲੱਗਦਾ ਹੈਗਾ ਵਾ ਅਤੇ ਉਹ ਜਿਹੜੀ ਪੇਂਟਿੰਗ ਦੀ ਲੁੱਕ ਹੈਗੀ ਆ ਉਹ ਸਾਰੀ ਹੀ ਚੇਂਜ ਹੋ ਜਾਂਦੀ ਆ ਫਰੇਮਿੰਗ ਦੇ ਨਾਲ ਫਰੇਮਿੰਗ ਦੇ ਇੱਕ ਮੈਂ ਲਗਾਈ ਸੀ ਆਪਣੀ ਫੈਮਲੀ ਦੀ ਫੈਮਲੀ ਫੋਟੋ ਸੀ ਅਤੇ ਉਹਨੂੰ ਮੈਂ ਫਰੇਮਿੰਗ ਕਰਵਾਈ ਸੀ ਅਤੇ ਉਹਦਾ ਜਿਹੜਾ ਫਰੇਮ ਆ ਉਹ ਬਹੁਤ ਹੀ ਜ਼ਿਆਦਾ ਮੀਨਜ਼ ਵੱਡਾ ਸੀ ਅਤੇ ਜਦੋਂ ਮੈਂ ਉਹਨੂੰ ਆਪਣੀ ਦੀਵਾਰ 'ਤੇ ਲਗਾਇਆ ਆਪਣੇ ਵੋਲ 'ਤੇ ਰੂਮ ਦੀ 'ਤੇ ਫਰੇਮਿੰਗ ਇੰਨੀ ਵਧੀਆ ਸੀ ਕਿ ਮੀਨਜ਼ ਵੇਖਣ ਵਾਲੇ ਨੂੰ ਇੰਨੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੇਰੇ ਪੇਰੈਂਟਸ ਨੂੰ ਦੇਖ ਕੇ ਇੱਕ ਤਾਂ ਮੈਂ ਜਿਹੜੀ ਫੋਟੋ ਸੀ ਉਹ ਬਹੁਤ ਸੋਹਣੀ ਰੈਡੀ ਕੀਤੀ ਸੀ ਅਤੇ ਜਦੋਂ ਫਰੇਮਿੰਗ ਕਰਵਾਈ ਉਹਦੀ ਲੁੱਕ ਜਿਹੜੀ ਉਹ ਬਹੁਤ ਜ਼ਿਆਦੀ ਹੀ ਸੋਹਣੀ ਹੋ ਗਈ ਦੀਵਾਰ 'ਤੇ ਟੰਗੀ ਅਤੇ ਉਹਦੀ ਜਿਹੜੀ ਗ੍ਰੇਸਫੁੱਲ ਆ ਉਹ ਸਭ ਇਹੀ ਕਹਿ ਰਹੇ ਸੀ ਕਿੱਥੋਂ ਜਿਵੇਂ ਬਣਵਾ ਕੇ ਲੈ ਕੇ ਆਏ ਨੇ ਅਤੇ ਬਹੁਤ ਹੀ ਸੋਹਣਾ ਫਰੇਮ ਕਰਵਾਈ ਦਾ ਹੈ ਪਹਿਲਾਂ ਇਹ ਸੀ ਕਿ ਮੈਂ ਫਰੇਮਿੰਗ ਆਪਣੇ ਘਰ ਕਰ ਦਿੰਦੀ ਸੀ ਫੇਰ ਮੈਂ ਬਾਅਦ ਵਿੱਚ ਫਰੇਮ ਲੈਣੇ ਸ਼ੁਰੂ ਕੀਤੇ ਫਰੇਮਿੰਗ ਘਰ ਵੀ ਹੋ ਜਾਂਦੀ ਆ ਮੈਂ ਖੁਦ ਵੀ ਕਈ ਵਾਰ ਬਣਾਉਂਦੀ ਹੁੰਦੀ ਹਾਂ ਕਾਡਬੋਰਡ ਦੀ ਲੈ ਕੇ ਫਰੇਮਿੰਗ ਉਹ ਵੀ ਬਹੁਤ ਸੋਹਣੀ ਲੱਗਦੀ ਕਿ ਜੇ ਮੈਂ ਖੁਦ ਡੈਕੋਰੇਟ ਕਰਾਂ ਕਾਡਬੋਰਡ ਦੀ ਫਰੇਮਿੰਗ ਉਹ ਵੀ ਬਹੁਤ ਵਧੀਆ ਬਣਦੀ ਹੈਗੀ ਆ ਕਾਡਬੋਰਡ ਲੈ ਕੇ ਉਹ ਤਾਂ ਗਲਿਊ ਲਗਾ ਕੇ ਚੀਜ਼ ਭਾਵੇਂ ਸਾਈਡ 'ਤੇ ਸਪਾਰਕ ਸ਼ੀਟ ਲਗਾ ਲਓ ਉੱਤੇ ਸਟੋਨਜ਼ ਵਗੈਰਾ ਜਾਂ ਮਿਰਰ ਵਰਕ ਕਰੀਏ ਉਹ ਵੀ ਬਹੁਤ ਸੋਹਣੀ ਆ ਫਰੇਮਿੰਗ ਨਾਲ ਕੀ ਆ ਪੇਂਟਿੰਗ ਦੀ ਵੀ ਲੁੱਕ ਹੁੰਦੀ ਉਹ ਸਾਰੀ ਹੀ ਚੇਂਜ ਹੋ ਜਾਂਦੀ ਆ